ਗਾਉਣ ਅਤੇ ਸੰਗੀਤ ਦੀ ਮੇਰੀ ਪਸੰਦੀਦਾ ਸ਼ੈਲੀ ਦੋ ਤਰ੍ਹਾਂ ਦੀ ਹਨ ਇੱਕ ਪਿਆਰਾ ਸੰਗੀਤ ਅਤੇ ਇੱਕ ਦੂਜਾ ਹਾਰਡਕੋਰ ਜਿਹੜਾ ਅੱਜ ਕੱਲ੍ਹ ਰੈਪ ਕਹਿੰਦੇ ਨੇ ਉਹ ਸੰਗੀਤ ਹਾਰਡਕੋਰ ਰੈਪ ਵਾਸਤੇ ਮੈਂ ਅੱਜ ਕੱਲ੍ਹ ਡਿਵਾਈਨ ਬਾਦਸ਼ਾਹ ਰਫਤਾਰ ਕਿੰਗ ਪੈਰਾਡੋਕਸ ਸਾਰਿਆਂ ਨੂੰ ਸੁਣਦਾ ਹਾਂ ਅਤੇ ਪਿਆਰਾ ਸੰਗੀਤ ਵਾਸਤੇ ਮੈਂ ਥੋੜ੍ਹੇ ਬਹੁਤੇ ਪੰਜਾਬੀ ਜਾਂ ਅਰਜੀਤ ਸਿੰਘ ਵਗੈਰਾ ਜਸ ਮਾਨਕ ਗੁਰੀ ਇਹਨਾਂ ਨੂੰ ਸੁਣਦਾ ਹਾਂ ਇਹਨਾਂ ਦੇ ਗਾਣੇ ਬੜੇ ਹੀ ਪਿਆਰੇ ਅਤੇ ਪਤਲੇ ਪਤਲੇ ਹੁੰਦੇ ਹਨ ਜਿਹਨਾਂ ਨੂੰ ਸੁਣ ਕੇ ਕੰਨਾਂ ਨੂੰ ਬਹੁਤ ਹੀ ਜ਼ਿਆਦਾ ਸੁਕੂਨ ਮਿਲਦਾ ਹੈ ਬਾਕੀ ਜਦੋਂ ਮੈਂ ਬਹੁਤ ਹੀ ਜ਼ਿਆਦਾ ਜੋਸ਼ ਵਗੈਰਾ ਵਿੱਚ ਹੁੰਦਾ ਹਾਂ ਤਾਂ ਮੈਂ ਰਫਤਾਰ ਡਿਵਾਈਨ ਵਗੈਰਾ ਦੇ ਗਾਣੇ ਸੁਣਦਾ ਹਾਂ ਮੈਨੂੰ ਇਹਨਾਂ ਦੇ ਗਾਣੇ ਸੁਣਨੇ ਬਹੁਤ ਪਸੰਦ ਹਨ ਮੈਂ ਜਦੋਂ ਵੀ ਵੇਹਲਾ ਹੁੰਦਾ ਹਾਂ ਜਾਂ ਕੋਈ ਲਿਖਣ ਵਗੈਰਾ ਦਾ ਕੰਮ ਕਰ ਰਿਹਾ ਹੁੰਦਾ ਹਾਂ ਤਾਂ ਮੈਂ ਇਹਨਾਂ ਨੂੰ ਹੀ ਸੁਣਦਾ ਹਾਂ ਮੈਨੂੰ ਗਾਣੇ ਸੁਣਣ ਦਾ ਬਹੁਤ ਹੀ ਜ਼ਿਆਦਾ ਮਜ਼ਾ ਆਉਂਦਾ ਹੈ ਅਤੇ ਮੈਂ ਇੱਕ ਅੱਧਾ ਗਾਣਾ ਲਿਖਿਆ ਹੋਇਆ ਵੀ ਹੈ ਕਿਉਂਕਿ ਮੈਨੂੰ ਗਾਉਣਾ ਨਹੀਂ ਆਉਂਦਾ ਬਟ ਮੈਨੂੰ ਲਿਖਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਉਹਨਾਂ ਨੂੰ ਸੁਣ ਸੁਣ ਕੇ ਅਤੇ ਮੈਨੂੰ ਮੈਂ ਇਹ ਸ਼ੌਂਕ ਵੀ ਉਹਨਾਂ ਨੂੰ ਸੁਣ ਸੁਣ ਕੇ ਹੀ ਪਿਆ ਹੈ ਮੈਨੂੰ ਉਹਨਾਂ ਦਾ ਗਾਣੇ ਬਹੁਤ ਜ਼ਿਆਦਾ ਪਸੰਦ ਹਨ ਅਤੇ ਮੈਂ ਉਹਨੂੰ ਬਹੁਤ ਜ਼ਿਆਦਾ ਸੁਣਦਾ ਹਾਂ